ਪੰਛੀਆਂ ਦੀ ਬੋਲੀ ਤਾਂ ਬੜੀ ਮਿੱਠੀ ਹੁੰਦੀ ਹੈ ਉਹ ਆਪਣੀ ਸੁਰੀਲੀ ਅਤੇ ਪਿਆਰੀ ਅਵਾਜ਼ ਦੇ ਨਾਲ਼ ਸਾਰਿਆਂ ਦਾ ਮਨ ਮੋਹ ਲੈਂਦੇ ਹਨ ਪਰ ਇਹ ਗੱਲ ਹਰ ਪੰਛੀ 'ਤੇ ਲਾਗੂ ਨਹੀਂ ਹੁੰਦੀ ਹੁਣ ਜਿਵੇਂ ਕਿ ਚਿੜੀ ਦੀ ਅਵਾਜ਼ ਹੈ ਉਹ ਚਿੜੀ ਚੀਂ ਚੀਂ ਕਰਦੀ ਹੈ ਅਤੇ ਉਹ ਆਪਣੀ ਮਿੱਠੀ ਜਿਹੀ ਅਵਾਜ਼ ਵਿੱਚ ਚੀਂ ਚੀਂ ਚੀਂ ਚੀਂ ਸਾਰਾ ਦਿਨ ਕਰਕੇ ਅਵਾਜ਼ਾਂ ਕੱਢਦੀ ਰਹਿੰਦੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਸਾਰੇ ਪੰਛੀਆਂ ਦੀ ਅਵਾਜ਼ ਮਿੱਠੀ ਹੋਵੇ ਜਿਵੇਂ ਕਿ ਹੁਣ ਕਾਂ ਹੈ ਉਹ ਕਾਂ ਕਾਂ ਕਰਦਾ ਹੈ ਅਤੇ ਸਿਰ ਖਾ ਜਾਂਦਾ ਹੈ ਕਾਂ ਦੀ ਅਵਾਜ਼ ਨੂੰ ਸੁਣਨਾ ਕੋਈ ਵੀ ਪਸੰਦ ਨਹੀਂ ਕਰਦਾ ਉਹ ਬਹੁਤ ਰੋਲਾ ਪਾਉਂਦਾ ਹੈ ਪਰ ਜਿਵੇਂ ਕਿ ਅਸੀਂ ਦੇਖਦੇ ਹਾਂ ਮੋਰ ਹੈ ਜਦੋਂ ਵੀ ਮੀਂਹ ਪੈਂਦਾ ਹੈ ਅਤੇ ਮੋਰ ਬਹੁਤ ਸੋਹਣੀ ਅਵਾਜ਼ ਕਰਦਾ ਹੈ ਅਤੇ ਮੋਰ ਦੀ ਸੁਰੀਲੀ ਅਵਾਜ਼ ਸੁਣ ਕੇ ਮਨ ਖੁਸ਼ ਹੋ ਜਾਂਦਾ ਹੈ ਅਤੇ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਅਵਾਜ਼ ਕੋਇਲ ਦੀ ਲੱਗਦੀ ਹੈ ਮੈਂ ਜਦੋਂ ਬਚਪਨ ਦੇ ਵਿੱਚ ਵੀ ਸੀਗੀ ਅਤੇ ਮੇਰੀ ਨਾਨੀ ਦਾ ਘਰ ਕਪੂਰਥਲੇ ਦੇ ਕੋਲ ਹੀ ਇੱਕ ਪਿੰਡ ਵਿੱਚ ਹੈ ਓਥੇ ਪਿੰਡ ਦੇ ਵਿੱਚ ਬਹੁਤ ਸਾਰੇ ਪੇੜ ਪੌਦੇ ਲੱਗੇ ਹੁੰਦੇ ਹਨ ਮੇਰੀ ਨਾਨੀ ਦੇ ਘਰ ਦੇ ਵਿਹੜੇ ਵਿੱਚ ਵੀ ਇੱਕ ਬਹੁਤ ਵੱਡਾ ਪੇੜ ਲੱਗਾ ਹੋਇਆ ਹੈ ਓਥੇ ਕੋਇਲ ਆ ਕੇ ਬੈਠਦੀਆਂ ਸਨ ਅਤੇ ਅੱਜ ਵੀ ਓਥੇ ਕੋਇਲ ਆਉਂਦੀ ਹੈ ਅਤੇ ਕੋਇਲ ਦੀ ਮਿੱਠੀ ਅਵਾਜ਼ ਸੁਣ ਕੇ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ ਕੋਇਲ ਓਥੇ ਸਾਰਾ ਦਿਨ ਬਹਿ ਕੇ ਬੜੀ ਸੁਰੀਲੀ ਅਵਾਜ਼ ਦੇ ਵਿੱਚ ਆਪਣੇ ਵਲੋਂ ਗੱਲਾਂ ਕਰਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਉਹਦੀ ਉਹ ਅਵਾਜ਼ ਬਹੁਤ ਹੀ ਜ਼ਿਆਦਾ ਪਸੰਦ ਆਉਂਦੀ ਹੈ ਅਤੇ ਇਸੇ ਤਰ੍ਹਾਂ ਹੋਰ ਵੀ ਕਈ ਪੰਛੀ ਹਨ ਜਿਹੜੇ ਕਿ ਅਲੱਗ ਅਲੱਗ ਤਰ੍ਹਾਂ ਦੀਆਂ ਅਵਾਜ਼ਾਂ ਕੱਢ ਕੇ ਸਾਨੂੰ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਧੰਨਵਾਦ